ਮੇਰਾ ਪਸੰਦੀਦਾ ਅਭਿਨੇਤਾ ਹੈ ਗਿੱਪੀ ਗਰੇਵਾਲ ਉਸ ਦੀਆਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਆਈਆਂ ਨੇ ਬਹੁਤ ਗਾਣੇ ਆਏ ਨੇ ਅਤੇ ਸਾਰੇ ਹੀ ਬਹੁਤ ਹੀ ਵਧੀਆ ਨੇ ਅਤੇ ਉਹਨਾਂ ਫਿਲਮਾਂ ਦੇ ਵਿੱਚੋਂ ਮੈਨੂੰ ਜਿਹੜੀ ਸਭ ਤੋਂ ਵੱਧ ਵਧੀਆ ਲੱਗੀ ਉਹ ਫਿਲਮ ਹੈਗੀ ਹੈ ਕੈਰੀ ਓਨ ਜੱਟਾ ਕੈਰੀ ਓਨ ਜੱਟਾ ਦੇ ਵਿੱਚ ਉਸ ਦਾ ਕਿਰਦਾਰ ਇੰਨਾ ਕੁ ਵਧੀਆ ਹੈ ਕਿ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਦਿਲ ਜਿੱਤ ਲੈਂਦਾ ਹੈ ਅਤੇ ਹਸਾ ਹਸਾ ਕੇ ਉਹ ਬਹੁਤ ਮਤਲਬ ਐਂਟਰਟੇਨ ਕਰਦਾ ਦਰਸ਼ਕਾਂ ਨੂੰ ਅਤੇ ਉਸ ਦੇ ਵਿੱਚ ਜਿਹੜੀ ਉਹਦੀ ਕਾਮੇਡੀ ਮੂਵੀਜ਼ ਨੇ ਉਹ ਬਹੁਤ ਹੀ ਵਧੀਆ ਨੇ ਅਤੇ ਉਹਨਾਂ ਦੇ ਵਿੱਚੋਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਕੈਰੀ ਓਨ ਜੱਟਾ ਬਹੁਤ ਹੀ ਵਧੀਆ ਲੱਗਦੀ ਹੈ ਮੈਨੂੰ ਕਿਉਂ ਵਧੀਆ ਲੱਗਦੀ ਹੈ ਕਿ ਉਹ ਬਹੁਤ ਹੀ ਰੋਚਕ ਹੈਗੀ ਹੈ ਅਤੇ ਉਹਦੀ ਇੱਕ ਸਟੋਰੀ ਵੀ ਹਮੇਸ਼ਾ ਜਿਵੇਂ ਇੱਕ ਸਸਪੈਂਸ ਰੱਖਿਆ ਜਾਂਦਾ ਉਹਦੇ ਵਿੱਚ ਕਿ ਅੱਗੇ ਕੀ ਹੋਊਗਾ ਅੱਗੇ ਕੀ ਹੋਊਗਾ ਅਤੇ ਉਹ ਸਸਪੈਂਸ ਹੁੰਦੇ ਹੁੰਦੇ ਹੱਸ ਹੱਸ ਕੇ ਬੰਦੇ ਦਾ ਢਿੱਡ ਪੀੜ ਹੋਣ ਲੱਗ ਜਾਂਦਾ ਪਰ ਹਾਸਾ ਉਸ ਫਿਲਮ ਦੇ ਵਿੱਚ ਖਤਮ ਨਹੀਂ ਹੁੰਦਾ ਅਤੇ ਹੱਸਦੇ ਹੱਸਦੇ ਉਹ ਫਿਲਮ ਖਤਮ ਹੋ ਜਾਂਦੀ ਹੈ